ਰਾਜ ਦੀ ਕੁਰ ਕੁਦਰਤੀ ਸੁੰਦਰਤਾ ਦਾ ਜੋ ਅਨੁਭਵ ਹੈ ਇਹਦੇ ਵਿੱਚ ਜਿਵੇਂ ਕਿ ਆਪਣਾ ਬਾਰਡਰ ਆ ਜਾਂਦੇ ਆ ਇੱਕ ਹੁਸੈਨੀ ਵਾਲਾ ਬਾਰਡਰ ਫਿਰੋਜ਼ਪੁਰ ਜਾਂ ਰਾਸ਼ਟਰੀ ਪਾਰਕ ਹੋ ਗਈ ਜੰਗਲੀ ਜੀਵ ਅਸਥਾਨ ਹੋ ਗਏ ਰਾਸ਼ਟਰੀ ਪਾਰਕ ਹੋ ਗਈ ਜਾਂ ਹੁਸੈਨੀ ਵਾਲਾ ਬਾਰਡਰ ਇਨ ਫਿਰੋਜ਼ਪੁਰ ਹੈ ਅੰਮ੍ਰਿਤਸਰ ਕੋਲ ਉਸ ਬਾਰਡਰ ਇੱਕ ਇਹ ਵਿਸ਼ੇਸ਼ਤਾ ਹੈ ਕਿ ਸ਼ਾਮ ਨੂੰ ਜੋ ਪਰੇਡ ਹੁੰਦੀ ਹੈ ਉਸ ਪਰੇਡ ਦੇ ਵਿੱਚ ਇੰਡੀਅਨ ਆਰਮੀ ਭਾਰਤੀ ਸੈਨਾ ਪਾਕਿਸਤਾਨੀ ਸੈਨਾ ਪਾਰਟੀਸਪੇਟ ਕਰਦੀ ਹੈ ਪਰੇਡ ਹੁੰਦੀ ਆ ਉਸ ਪਰੇਡ ਨੂੰ ਦੇਖਣ ਲਈ ਜੋ ਸੈਲਾਨੀ ਲੋਕ ਵੀ ਆਉਂਦੇ ਨੇ ਪੰਜਾਬ ਦੇ ਸੈਲਾਨੀ ਲੋਕ ਵੀ ਹੁੰਦੇ ਨੇ ਪੰਜਾਬ ਦੇ ਟੂਰਿਸਟ ਵੀ ਹੁੰਦੇ ਨੇ ਸ਼ਾਮ ਦੇ ਵੇਲੇ ਪਰੇਡ ਤੋਂ ਬਾਅਦ ਦੋਨਾਂ ਜੋ ਰਾਜਾਂ ਦੇ ਪਾਕਿਸਤਾਨ ਅਤੇ ਇੰਡੀਆ ਦੇ ਜੋ ਰਾਸ਼ਟਰੀ ਝੰਡੇ ਹੈ ਉਹਨਾਂ ਨੂੰ ਉਤਾਰਿਆ ਜਾਂਦਾ ਉਹਨਾਂ ਦੇ ਸਨਮਾਨ ਦੇ ਵਿੱਚ ਦੋਨਾਂ ਦੇਸ਼ਾਂ ਦੀ ਜੋ ਟੂਰਿਸਟ ਨੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਉਸ ਝੰਡੇ ਦਾ ਸਨਮਾਨ ਕਰਦੇ ਆ ਤਾ ਉਸ ਜੋ ਹੁਸੈਨੀਵਾਲਾ ਬਾਰਡਰ ਹੈ ਉਸਦੀ ਇਹ ਬੜੀ ਨਿਵੇਕਲੀ ਅਤੇ ਸੁੰਦਰ ਤਸਵੀਰ ਹੈ ਜੋ ਕਿ ਸਭ ਨੂੰ ਬੜੀ ਪ੍ਰਭਾਵਿਤ ਅਤੇ ਆਨੰਦਿਤ ਕਰਦੀ ਹੈ ਉਸ ਤੋਂ ਬਾਅਦ ਜਿਵੇਂ ਰਾਸ਼ਟਰੀ ਪਾਰਕ ਹੋ ਗਈ ਜਿਵੇਂ ਪੰਜਾਬ ਖ਼ਾਸ ਕਰਕੇ ਬਠਿੰਡਾ ਦੇ ਵਿੱਚ ਇੱਕ ਸ਼ਤਬੀਡ ਜੂਹ ਹੈ ਚਿੜੀਆਘਰ ਐ ਉੱਥੇ ਅਲੱਗ ਅਲੱਗ ਤਰ੍ਹਾਂ ਦੇ ਜਾਨਵਰ ਮਿਲਦੇ ਹੈ ਤਾਂ ਉਹ ਵੀ ਜੋ ਇੱਕ ਸਾਡੇ ਰਾਜ ਦੀ ਜਾਂ ਪੰਜਾਬ ਰਾਜ ਦੀ ਕੁਦਰਤੀ ਸੁੰਦਰਤਾ ਨੂੰ ਚਾਰ ਚੰਦ ਲਾਉਂਦੀ ਹੈ ਉੱਥੇ ਵੀ ਲੋਕ ਸੈਲਾਨੀ ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚਦੇ ਹੈ ਕਿ ਅਲੱਗ ਅਲੱਗ ਜੰਗਲੀ ਜਾਨਵਰ ਉੱਥੇ ਰੱਖੇ ਜਾਂਦੇ ਅਤੇ ਉੱਥੇ ਉਹਨਾਂ ਦੇ ਉਹਨਾਂ ਨੂੰ ਦੇਖ ਕੇ ਜੋ ਬੱਚੇ ਬੜਾ ਆਨੰਦ ਮਹਿਸੂਸ ਕਰਦੇ ਆ ਅਤੇ ਬੜੀ ਜਨਰਲ ਨੌਲੇਜ ਵੀ ਉਥੋਂ ਇਕੱਠੀ ਕਰਦੇ ਹੈ ਤਾਂ ਇਸ ਤਰ੍ਹਾਂ ਦੀ ਜੋ ਹੋਰ ਪੰਛੀਆਂ ਦੀਆਂ ਸੈਚਰੀਜ ਹੈ ਜਿਵੇਂ ਅਬੋਹਰ ਵੀ ਹੈ ਇੱਕ ਬਠਿੰਡਾ ਵੀ ਹੈ ਪਟਿਆਲਾ ਦੇ ਵਿੱਚ ਵੀ ਹੈ ਤਾਂ ਪਟਿਆਲਾ ਦੇ ਵਿੱਚ ਵੀ ਜੋ ਬਰਡ ਸੈਂਟਰੀਜ਼ ਹੈ ਉਹ ਉੱਥੇ ਅੰਮ੍ਰਿਤਸਰ ਵਿੱਚ ਵੀ ਹੈ ਉੱਥੇ ਵੀ ਅਲੱਗ ਅਲੱਗ ਤਰ੍ਹਾਂ ਦੇ ਪੰਛੀ ਜਾਨਵਰ ਪਾਏ ਜਾਂਦੇ ਆ ਕੁਛ ਜੋ ਅਹ ਜੋ ਆਪਣੇ ਚਿੜੀਆਘਰ ਹਨ ਜਾਂ ਪੰਛੀਆਂ ਦੀ ਸੈਨਚਰੀਜ ਹੈ ਉਹਨਾਂ ਨੂੰ ਨੈਸ਼ਨਲ ਜੋ ਸਨਮਾਨ ਵੀ ਮਿਲੇ ਹੋਏ ਨੇ ਰਾਸ਼ਟਰੀ ਅਵਾਰਡ ਵੀ ਮਿਲੇ ਹੋਏ ਨੇ ਕੁਛ ਨੂੰ ਇੰਟਰਨੈਸ਼ਨਲ ਅਵਾਰਡ ਨੂੰ ਮਿਲੀ ਹੋਏ ਜੋ ਕਿ ਪੰਜਾਬ ਰਾਜ ਦੀ ਕੁਦਰਤੀ ਸੁੰਦਰਤਾ ਨੂੰ ਹੋਰ ਚਾਰ ਚੰਨ ਲਾਉਂਦੇ ਆ ਅਤੇ ਸੈਲਾਨੀਆਂ ਦੀ ਸੈਲਾਨੀਆਂ ਲਈ ਇੱਕ ਖਿੱਚ ਦਾ ਕੇਂਦਰ ਵੀ ਬਣਦੇ ਹੈ ਸੋ ਸਰਕਾਰ ਵੀ ਇਹਨਾਂ ਨੂੰ ਮੈਨਟੇਨ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਦੀ ਹੈ ਔਰ ਜੋ ਸੈਲਾਨੀ ਲੋਕ ਹੁੰਦੇ ਜੋ ਪੰਜਾਬ ਦੇ ਲੋਕ ਵਸਨੀਕ ਨੇ ਉਹ ਵੀ ਉਹਨਾਂ ਅਤੇ ਸੁੰਦਰਤਾ ਨੂੰ ਕਾਇਮ ਰੱਖਣ ਲਈ ਆਪਣਾ ਪੂਰਾ ਯੋਗਦਾਨ ਪਾਉਂਦੇ ਹੈ